ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਵੇਂ ਤੁਸੀਂ ਠੀਕ ਠਾਕ ਹੋ ਹਾਂਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਅਸੀਂ ਅੱਜ ਬੱਚਿਆਂ ਦੀ ਭੂਆ ਕੋਲ ਗਏ ਸੀ ਜੀ ਹਾਂਜੀ ਅਸੀਂ ਕੱਲ ਗਏ ਸੀ ਅੱਜ ਆ ਗਏ ਜੀ ਇੱਕ ਰਾਤ ਲਾਈ ਸੀ ਜੀ ਕਾਰ 'ਤੇ ਗਏ ਸੀ ਖ਼ਰਾਬੀ ਕੀਤੀ ਸੀ ਥੋੜ੍ਹੀ ਜਿਹੀ ਜਾਂਦਿਆ ਤਾਂ ਠੀਕ ਗਈ ਹੈ ਜਲਾਲਾਬਾਦ ਕੋਲ ਆ ਕੇ ਖ਼ਰਾਬੀ ਕਰਨ ਲੱਗ ਗਈ ਫਿਰ ਅਸੀਂ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਜਿਹੜਾ ਹੈਗਾ ਨਾ ਕੀ ਹੁੰਦਾ ਉਹ ਬੈਰਿੰਗ ਬੈਰਿੰਗ ਕਹਿੰਦੇ ਖ਼ਰਾਬ ਹੋ ਗਿਆ ਅਰਟੀ ਐਂਟਰ ਨਾਲ ਅਲਟੀਨੇਟਰ ਨਾਲ ਬੈਰਿੰਗ ਲੱਗਦਾ ਸੀ ਅਤੇ ਉਹ ਸਲਿਪ ਕਰਦਾ ਸੀਗਾ ਉਹਦੀ ਛਣ ਛਣ ਜੀ ਦੀ ਆਵਾਜ਼ ਆਉਂਦੀ ਸੀ ਉਹਦੀ ਉੱਪਰੋਂ ਰਬੜ ਸਾਰੀ ਘਸ ਗਈ ਬੈਰੰਗ ਵਿੱਚੋਂ ਨਿਕਲ ਆਇਆ ਸੀ ਉਹ ਨਾਲ ਲੱਗ ਕੇ ਨਾ ਘਸ ਘਸ ਕਰਕੇ ਗਰਮ ਹੁੰਦਾ ਪਿਆ ਸੀ ਗਰਮ ਹੋ ਕੇ ਤੇ ਉਹ ਅਸੀਂ ਉੱਥੇ ਕਿਸ਼ਨਪੁਰੇ ਵੀ ਵਿਖਾਇਆ ਉੱਥੇ ਉਹ ਮਿਸਤਰੀ ਕਹਿੰਦੇ ਵੀ ਤੁਸੀਂ ਧਰਮਕੋਟ ਲੈ ਜਾਓ ਫਿਰ ਸਾਨੂੰ ਧਰਮਕੋਟ ਸਹੀ ਨਹੀਂ ਲੱਗਿਆ ਤਾਂ ਅਸੀਂ ਮੋਗੇ ਲੈ ਆਏ ਮੋਗਿਓ ਸਾਨੂੰ ਇੱਕ ਦੁਕਾਨ ਖੁੱਲ੍ਹੀ ਮਿਲੀ ਅਸੀਂ ਉੱਥੇ ਫਿਰ ਬੈਰਿੰਗ ਪੁਆਇਆ ਜੀ ਫਿਰ ਅਸੀਂ ਬੈਰੰਗ ਪਵਾ ਕੇ ਫਿਰ ਅਸੀਂ ਹੌਲੀ ਹੌਲੀ ਫਿਰ ਫਿਰ ਅਸੀਂ ਸੌ ਦੀ ਸਪੀਡ 'ਤੇ ਗੱਡੀ ਲਿਆਂਦੀ ਹਾਂਜੀ ਖਰੇ ਡਰਾਈਵਰ ਫਿਰ ਅਸੀਂ ਬਹੁਤ ਤੇਜ਼ ਚਲਦਾ ਸੀ

ਹਾਂਜੀ ਨਿਤਨੇਮ ਕਰ ਲਿਆ ਸੀ ਜੀ ਹਾਂਜੀ ਸਵੇਰ ਦਾ ਵੀ ਕਰ ਲਿਆ ਸੀ

ਆਲੂ ਮਟਰ ਜੀ ਅਤੇ ਇਹਨਾਂ ਦੀ ਭੂਆ ਨੇ ਚੌਲ ਬਣਾਏ ਸੀ ਲੂਣ ਵਾਲੇ ਜੀ ਹਾਂਜੀ

ਸਵੇਰੇ ਸਵੇਰੇ ਹਾਂਜੀ ਚਟਨੀ ਨਾਲ ਚਟਨੀ ਬੜੀ ਸਵਾਦ ਬਣਾਈ ਸੀ ਹਾਂਜੀ ਕੱਲ੍ਹ ਸ਼ਨੀਵਾਰ ਤਾ ਅੱਜ ਐਤਵਾਰ ਸੀ ਅੱਜ ਤਾਂ ਘਰੇ ਸੀ ਜੀ ਕੱਲ੍ਹ ਨੂੰ ਜਾਣਗੇ ਹੀ ਪੇਪਰ ਹੁਣ ਨੇੜੇ ਹਾਂਜੀ ਹਾਂਜੀ ਹਾਂਜੀ ਆਪਣੀ ਬਲਪ੍ਰੀਤ ਦੇ ਪੇਪਰ ਤਾਂ ਹੈਗੇ ਆ ਸਤਾਰ੍ਹਾਂ ਤੋਂ ਸ਼ੁਰੂ ਨੇ

ਹਾਂਜੀ ਦਲਜੀਤ ਦੇ ਅਜੇ ਮਾਰਚ ਤੋਂ ਜੀ

ਮੈਂ ਤਾਂ ਕਹੀ ਜਾਂਦੀ ਹਾਂ ਜੀ ਜੇ ਆਖੇ ਲੱਗੂ ਤਾਂ ਹੀ ਨਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ